ਹਾਂਜੀ ਮੈਂ ਤੁਹਾਨੂੰ ਸੂਟਾਂ ਦੀ ਜਾਣਕਾਰੀ ਬਾਰੇ ਦੱਸ ਸਕਦੀ ਹਾਂ ਸੂਟਾਂ ਦੇ ਰੇਟ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਹਨ ਕਪ ਸੂਟਾਂ ਦੇ ਰੇਟ ਹਰ ਤਰ੍ਹਾਂ ਦੇ ਕੱਪੜੇ 'ਤੇ ਡਿਪੈਂਡ ਹੁੰਦੇ ਹਨ ਅਗਰ ਕੋਟਨ ਦਾ ਸੂਟ ਹੋਵੇ ਤਾਂ ਫਿਰ ਕੋਟਨ ਦੇ ਸੂਟ ਸਿਲਕ ਦੇ ਸੂਟ ਚੌੜੇ ਪੋਂਚੇ ਜਾਂ ਪਾਈਪਿੰਗ ਉਸ ਹਰ ਤਰ੍ਹਾਂ ਦੇ ਡਿਜ਼ਾਇਨ 'ਤੇ ਨਿਰਭਰ ਹੁੰਦੇ ਹਨ ਅਤੇ ਪਾਈਪਿੰਗ ਲਗਾਉਣੀ ਜੇ ਅਗਰ ਪਾਈਪਿੰਗ ਲਗਾਉਣੀ ਹੋਵੇ ਚੌੜੇ ਪੋਂਚੇ ਬਣਾਉਣੇ ਕੋਈ ਡਿਜ਼ਾਇਨ ਕੋਈ ਲੈਸ ਵਗੈਰਾ ਲਗਾਉਣੀ ਹੋਵੇ ਤਾਂ ਉਸ 'ਤੇ ਨਿਰਭਰ ਹੁੰਦਾ ਹੈ ਹਰ ਤਰ੍ਹਾਂ ਦੇ ਸੂਟ ਡਿਜ਼ਾਇਨ ਅਤੇ ਰੇਟ ਉਹਨਾਂ ਦੇ ਨਿਰਭਰ ਕਰਦੇ ਹਨ ਮੈਂ ਸਿੰਪਲ ਸੂਟ ਦੇ ਤਿੰਨ ਸੌ ਰੁਪਇਆ ਲੈਂਦੀ ਢਾਈ ਸੌ ਰੁਪਇਆ ਵੀ ਲੈ ਲੈਂਦੀ ਹਾਂ ਅਗਰ ਪਾਈਪਿੰਗ ਲਗਾਉਣੀ ਹੋਵੇ ਤਾਂ ਪੰਜਾਹ ਰੁਪਏ ਵੱਧ ਲੈਂਦੀ ਹਾਂ ਅਤੇ ਜੇ ਚੌੜੇ ਪੋਂਚੇ ਬਣਾਉਣੇ ਹੋਣ ਤਾਂ ਪੰਜਾਹ ਰੁਪਏ ਵੱਧ ਲੈਂਦੀ ਹਾਂ ਨ ਅਗਰ ਕੋਈ ਲੈਸ ਵਗੈਰਾ ਲੈਣੀ ਹੋਵੇ ਲਗਾਉਣੀ ਹੋਵੇ ਤਾਂ ਫਿਰ ਵੀ ਥੋੜ੍ਹੇ ਬਹੁਤ ਪੈਸੇ ਵੱਧ ਲੈ ਲੈਂਦੀ ਹਾਂ ਅਤੇ ਅਗਰ ਇਕੱਲੇ ਕਮੀਜ਼ 'ਤੇ ਹੀ ਲਾਈਨਿੰਗ ਲਗਾਉਣੀ ਹੋਵੇ ਤਾਂ ਫਿਰ ਮੈਂ ਦੋ ਸੌ ਢਾਈ ਸੌ ਰੁਪਇਆ ਲੈਂਦੀ ਹਾਂ ਅਗਰ ਸਲਵਾਰ 'ਤੇ ਵੀ ਲਾਈਨਿੰਗ ਲਗਾਉਣੀ ਹੋਵੇ ਤਾਂ ਫਿਰ ਮੈਂ ਸਾਢੇ ਤਿੰਨ ਸੌ ਰੁਪਇਆ ਲੈਂਦੀ ਹਾਂ ਅਤੇ ਫਿਰ ਅਗਰ ਉ ਉਸਦਾ ਨੈਕ ਕੋਈ ਡਿਜਾਇਨਰ ਬਣਾਉਣਾ ਹੋਵੇ ਤਾਂ ਉਸ ਦੇ ਵੀ ਅਲੱਗ ਪੈਸੇ ਲੈਂਦੀ ਹਾਂ ਇਸ ਨੂੰ ਸੋਹਣਾ ਬਣਾਉਣ ਲਈ ਫਿਰ ਲੈਸ ਵਗੈਰਾ ਪਾਈਪਿੰਗ ਵਗੈਰਾ ਲਗਾ ਕੇ ਸ ਸੋਹਣਾ ਬਣਾ ਦਿੰਦੀ ਹਾਂ ਇਸ ਨੂੰ